ਹੈਲੋ ਰੋਆਇਲ ਰੈਸਟੋਰੈਂਟ ਮੈਂ ਕਮਲਪ੍ਰੀਤ ਕੌਰ ਪਿੰਡ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਤੋਂ ਬੋਲਦੀ ਹਾਂ ਮੈਂ ਹਰ ਵਾਰ ਤੁਹਾਡੀ ਸਵੀਗੀ ਐਪ ਤੋਂ ਹੀ ਮਤਲਬ ਓਡਰ ਕਰਦੀ ਹਾਂ ਭੋਜਨ ਇਸ ਕਰਕੇ ਅੱਜ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਨੇ ਇਸ ਲਈ ਮੈਂ ਅੱਜ ਵੀ ਤੁਹਾਡੀ ਸਵੀਗੀ ਐਪ ਤੋਂ ਭੋਜਨ ਓਡਰ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਤੁਹਾਡੇ ਰੈਸਟੋਰੈਂਟ ਦਾ ਭੋਜਨ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਤੁਹਾਡੀ ਸਰਵਿਸ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਇਸ ਕਰਕੇ ਮੈਨੂੰ ਗੁਲਾਬ ਜਾਮੁਨ ਰੋਟੀ ਸਬਜ਼ੀ ਸਮੋਸਾ ਸਮੋਸੇ ਨਾਲ ਚੱਟਨੀ ਜ਼ਰੂਰ ਪਾ ਦਿਓ ਐਂਡ ਨੂਡਲਸ ਭੇਜ ਦਿਓ ਪ ਪਲੀਸ ਇਹ ਸਭ ਓਡਰ ਰ ਮੈਂ ਤੁਹਾਨੂੰ ਓਡਰ ਕੀਤਾ ਹੈ ਇਹ ਟਾਈਮ ਟੂ ਟਾਈਮ ਪਹੁੰਚਾ ਦਿਓ ਕਿਉਂਕਿ ਸਾਡੇ ਘਰ ਰਿਸ਼ਤੇਦਾਰ ਆ ਰਹੇ ਹਨ ਅਤੇ ਬਹੁਤ ਵੇਟ ਕਰ ਰਹੇ ਹਨ ਇਸ ਲਈ ਜਲਦੀ ਕੋਸ਼ਿਸ਼ ਕਰਿਓ ਵੀ ਓਡਰ ਜਲਦੀ ਪਹੁੰਚਾ ਦਿੱਤਾ ਜਾਵੇ ਐਂਡ ਨਾਲ ਸਮੋਸੇ ਦੇ ਨਾਲ ਚੱਟਨੀ ਜ਼ਰੂਰ ਪਾ ਦਿਓ ਸੌਂਫ ਪਾ ਦਿਓ ਅਤੇ ਟੀਸ਼ੂ ਪੇਪਰ ਭੇਜ ਦਿਓ ਜੋ ਵੀ ਤੁਹਾਡਾ ਬਿੱਲ ਬਣੇਗਾ ਉਹ ਮੈਨੂੰ ਦੱਸ ਦਿਓ ਮੈਂ ਪੇਅ ਕਰ ਦੇਵਾਂਗੀ ਥੈਂਕ ਯੂ ਧੰਨਵਾਦ ਰੋਆਇਲ ਰੈਸਟੋਰੈਂਟ